ਮੇਰੇ ਪਿੰਡ ਦਾ ਨਾਮ ਖਿਦਰਾਬਾਦ ਹੈ ਇਹ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਪੈਂਦਾ ਹੈ ਮੇਰਾ ਪਿੰਡ ਪੂਰੇ ਪੰਜਾਬ ਵਿੱਚੋਂ ਦੂਜੇ ਬ ਦੂਜੇ ਪਤਾ ਨਹੀਂ ਤੀਜੇ ਸਥਾਨ ਸਭ ਤੋਂ ਵੱਡੇ ਵੱਡਾ ਪਿੰਡ ਹੈ ਮੇਰੇ ਪਿੰਡ ਵਿੱਚ ਦੋ ਪੱਟੀਆਂ ਬਣੀਆਂ ਵੀਆਂ ਉੱਪਰਲੀ ਪੱਟੀ ਅਤੇ ਹੇਠਲੀ ਪੱਟੀ ਮੇਰਾ ਪਿੰਡ ਇੱਕ ਦੇ ਬਹੁਤ ਹੀ ਵਧੀਆ ਦੋ ਦੋਨੋਂ ਪੱਟੀਆਂ ਦੇ ਅਲੱਗ ਅਲੱਗ ਸਰਪੰਚ ਹਨ ਅਤੇ ਅਲੱਗ ਅਲੱਗ ਪੰਚਾਇਤਾਂ ਹਨ ਮੇਰੇ ਪਿੰਡ ਦੇ ਵਿੱਚ ਇੱਕ ਦੋ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰ ਇਤਿਹਾਸਿਕ ਗੁਰਦੁਆਰਾ ਸਾਹਿਬ ਹਨ ਪਹਿਲਾ ਗੁਰਦੁਆਰਾ ਸਾਹਿਬ ਦਸਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸੰਬੰਧਿਤ ਗੁਰਦੁਆਰਾ ਗੁਰਦੁਆਰਾ ਦਮਦਮਾ ਸਾਹਿਬ ਹੈ ਇਸ ਇਸ ਦਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਭਗਾਣੀ ਦੇ ਯੁੱਧ ਵਾਸਤੇ ਭਗਾਣੀ ਯੁੱਧ ਜਾ ਰਹੇ ਸੀ ਤਾਂ ਉਦੋਂ ਦੋਨੋਂ ਵਾਰ ਆਉਂਦੇ ਹੋਏ ਵੀ ਅਤੇ ਜਾਂਦੇ ਹੋਏ ਵੀ ਇਸ ਅਸਥਾਨ 'ਤੇ ਵਿਸ਼ਰਾਮ ਕੀਤਾ ਸੀ ਅਤੇ ਦੂਜਾ ਗੁਰਦੁਆਰਾ ਧੰਨ ਧੰਨ ਬਾਬਾ ਗੁਰਦੁਆਰਾ ਬਾਬਾ ਜ਼ੋਰਾਵਰ ਸਾਹਿਬ ਜੀ ਦਾ ਹੈ ਇਸ ਇਹ ਅਸਥਾਨ ਗੁਰੂ ਗੁਰੂ ਗੋਬਿੰਦ ਸਿੰਘ ਨੇ ਪਾ ਪਾ ਪਾ ਪਾਲਤੂ ਪੁੱਤਰ ਜਿਵੇਂ ਕਿ ਗੋਦ ਲਏ ਹੋਏ ਪੁੱਤਰ ਦੀ ਗੱਲ ਕਰੀਏ ਅਤੇ ਉਹਨਾਂ ਦੇ ਨਾਲ ਸੰਬੰਧਿਤ ਹੈ ਦੋਨੋਂ ਸਥਾਨ ਨੇ ਆਪਣੇ ਆਪ 'ਚ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਿਕ ਅਸਥਾਨ ਹਨ ਮੇਰੇ ਮੇਰੇ ਪਿੰਡ ਦਾ ਇੱਕ ਸਟੇਡੀਅਮ ਹੈ ਸ਼ਹੀਦ ਭਗਤ ਸਿੰਘ ਸਟੇਡੀਅਮ ਉੱਥੇ ਹਰ ਸਾਲ ਫੁੱਟਬਾਲ ਦੇ ਟੂਰਨਾਮੈਂਟ ਕ੍ਰਿਕਟ ਦੇ ਟੂਰਨਾਮੈਂਟ ਛਿੰਝ ਦੰਗਲ ਮੇਲੇ ਕਰਵਾਏ ਜਾਂਦੇ ਹਨ ਅਤੇ ਹੁਣ ਸਤੰਬਰ ਦੇ ਵਿੱਚ ਵੀ ਸਾਡੇ ਪਿੰਡ ਛਿੰਝ ਮੇਲਾ ਕਰਵਾਇਆ ਜਾ ਰਿਹਾ ਅਤੇ ਹੋਰ ਵੀ ਬਹੁਤ ਸਾਰੇ ਇਤਿਹਾਸਿਕ ਅਸਥਾਨ ਸਾਡੇ ਪਿੰਡ ਦੇ ਵਿੱਚ ਹਨ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਮੇਰਾ ਪਿੰਡ ਬਹੁਤ ਹੀ ਵਧੀਆ ਹੈ ਜੇਕਰ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ